ਹੈਲੋ

ਠੀਕ ਹੈ ਠੀਕ ਹੈ ਦਸ ਦਸ ਜੁਲਾਈ ਹੈ ਨਾ ਦਸ ਅਤੇ ਗਿਆਰਾਂ ਹਾਂਜੀ ਹਾਂਜੀ ਫ੍ਰੀ ਆ ਮੈਂ ਬਾਰਾਂ ਨੂੰ ਹੈ ਮੇਰਾ ਪ੍ਰੋਗਰਾਮ ਅੱਗੇ ਦਾ ਹਾਂਜੀ ਅੱਛਾ ਅਖੰਡ ਪਾਠ ਅੱਛਾ ਈ ਤੁਹਾਨੂੰ ਦੋ ਦਿਨਾਂ ਲਈ ਚਾਹੀਦਾ ਨਾ ਕੋਈ ਗੱਲ ਨਹੀਂ ਮੈਮ ਹਾਂਜੀ ਨਹੀਂ ਬ ਉਹ ਕੋਈ ਹਾਂਜੀ ਉਹ ਕੋਈ ਇਸ਼ੂ ਨਹੀਂ ਹੈ ਮੈਮ ਸਾਡੇ ਕੋਲ ਹੈਗੇ ਨੇ ਐਕਸਟਰਾ ਹੀ ਨੇ ਕੈਮਰਾ ਮਤਲਬ ਚਾਰ ਪੰਜ ਹੈਗੇ ਨੇ ਅਤੇ ਬਾਕੀ ਹਾਂਜੀ ਹੋ ਜੇਗਾ ਕੋਈ ਗੱਲ ਨਹੀਂ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਹਾਂਜੀ ਤੇ ਬਾਕੀ ਮੈਮ ਚਾਰਜਿਸ ਵਗੈਰਾ ਮਤਲਬ ਆਪਣੇ ਨੌਰਮਲ ਹੀ ਨੇ ਮਤਲਬ ਕਿ ਪੰਦਰਾਂ ਹਜ਼ਾਰ ਹੈ ਵੈਸੇ ਹਾਂਜੀ ਕਿਉਂਕਿ ਵਿੱਦ ਵੀਡੀਓਗ੍ਰਾਫੀ ਹੋਏਗੀ ਨਾ ਪਰੋਪਰ ਫੋਟੋਜ਼ ਵਗੈਰਾ ਹੋਣਗੀਆਂ ਕਲਿੱਕ ਵਗੈਰਾ ਅਤੇ ਉਹ ਹਾਂਜੀ ਤੁਹਾਨੂੰ ਪਰੋਪਰ ਐਂ ਉਹ ਕਲਿਪਸ ਵਗੈਰਾ ਸਭ ਐਨ ਪਰੋਪਰ ਮਿਲੇਗੀ ਮਤਲਬ ਵਧੀਆ ਦੇਖੋ ਮੈਮ ਜਿਹੜੇ ਕੈਮਰਾਸ ਨੇ ਨਾ ਦੇਖੋ ਵਧੀਆ ਕੁਆਲਟੀ ਦੇ ਨੇ ਕੋਈ ਐਂ ਵੀ ਨਹੀਂ ਹੈਗਾ ਤੁਹਾਨੂੰ ਐਂ ਬਿਲਕੁਲ ਐਂ ਓਰਿਜਨਲ ਵਿਊ ਮਿਲੇਗਾ ਨਹੀਂ ਦੇਖੋ ਕੈਮਰਾ ਤਾਂ ਕੈਮਰਾ ਤਾਂ ਬਾਕੀ ਹੈ ਐਂ ਨਾ ਕੈਪਚਰ ਕਰਨ ਦੀ ਵੀ ਇੱਕ ਉਹ ਹੁੰਦੀ ਹੈਗੀ ਹੈ ਨਾ ਵੀ ਉਹ ਫੋਟੋਗ੍ਰਾਫਰ ਸਾਡੇ ਪੂਰੇ ਮਤਲਬ ਵਧੀਆ ਮਤਲਬ ਅਸੀਂ ਖੁਦ ਕਰਾਂਗੇ ਹੈ ਨਾ ਵੀ ਤੁਸੀਂ ਉਹ ਉਹਦੀ ਕੋਈ ਇੱਦਾਂ ਕੋਈ ਆਉਣਾ ਨੀਗਾ ਦਿੱਕਤ ਬਾਕੀ ਕੋਈ ਗੱਲ ਨਹੀਂ ਮੈਮ ਦੇਖੋ ਵੈਸੇ ਤਾਂ ਦੇਖੋ ਰੀਜਨਲ ਰੀਜ਼ਨੇਬਲ ਹੀ ਹੈ ਪ੍ਰਾਈਸ ਦੇਖੋ ਹੈ ਨਾ ਬਾਕੀ ਕੋਈ ਬ ਗੱਲ ਨਹੀਂ ਥੋੜ੍ਹਾ ਬਹੁਤ ਕਰ ਲਵਾਂਗੇ ਅਡਜਸਟ ਅਤੇ

ਦੇਖੋ ਮੈਮ ਐਨਾ ਤਾਂ ਬਾਰਾ ਨਹੀਂ ਖਾਣਾ ਬਾਕੀ ਚਲੋ ਕੋਈ ਗੱਲ ਨਹੀਂ ਕਰ ਲਵਾਂਗੇ ਦੇਖੋ ਹੈ ਨਾ ਪੰਦਰਾਂ ਕੋਈ ਗੱਲ ਨਹੀਂ ਦੋ ਤਿੰਨ ਹਜ਼ਾਰ ਘੱਟ ਕਰ ਲਵਾਂਗੇ ਚਲੋ ਤੁਸੀਂ ਬਾਰਾਂ ਹਜ਼ਾਰ ਦੇ ਦਿਉ ਚਲੋ

ਬਾਕੀ ਹਾਂਜੀ ਕਿਹੜੀ ਜਗ੍ਹਾ ਮੈਮ

ਠੀਕ ਹੈ ਠੀਕ ਹੈ ਹਾਂਜੀ ਬਾਕੀ ਨਾ ਕਿਉਂਕਿ ਚਾਰ ਮੁੰਡੇ ਮੈਂ ਭੇਜੂ ਹੈ ਨਾ ਇੱਧਰੋਂ ਅਤੇ ਬਾਕੀ ਸਾਨੂੰ ਨਾ ਇੱਕ ਦਿਨ ਦਾ ਵੀ ਰਹਿਣ ਦਾ ਜੇਕਰ ਕਰਨਾ ਪੈਣਾ ਮੁੰਡਿਆਂ ਨੂੰ

ਹਾਂਜੀ ਬਾਕੀ ਹਾਂਜੀ ਉਹ ਅਡਵਾਂਸ ਹੁੰਦੀ ਹੈ ਫੀਸ ਪੰਜ ਕੁ ਹਜ਼ਾਰ ਤੁਸੀਂ ਸਬਮਿਟ ਕਰਵਾ ਦਿਉ ਪਹਿਲਾਂ ਹਾਂਜੀ

ਓਕੇ ਮੈਮ ਥੈਂਕ ਯੂ ਹਾਂਜੀ ਓਕੇ